ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਤੁਸੀਂ ਕਿਹੜੀਆਂ ਤਕਨੀਕਾਂ ਜਾਂ ਨੁਕਤੇ ਸਿੱਖੇ ਹਨ ਜੋ ਜਿਹਨਾਂ ਦੇ ਤੁਹਾਡੀ ਚਿੱਤਰਕਾਰੀ ਨੂੰ ਬਿਹਤਰ ਬਣਾਉਂਦੇ ਹਨ ਅਤੇ ਉਹਨਾਂ ਦੇ ਵਿੱਚ ਮਦਦ ਕੀਤੀ ਹੈ ਕਿਸ ਤੋਂ ਕੀ ਆਨਲਾਈਨ ਸਰੋਤ ਹਨ ਜੋ ਤੁਸੀਂ ਨਵੀਆਂ ਤਕਨੀਕਾਂ ਸਿੱਖਣਾ ਸਿੱਖਣ ਲਈ ਅਪਣਾਉਂਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾਂਗਾ ਆਨਲਾਈਨ ਸਰੋਤਿਆਂ ਜਿਵੇਂ ਕਿ ਕੋਈ ਵੀ ਚੀਜ਼ ਦੇਖਣੀ ਹੈ ਜਾਂ ਕਲਰ ਦੀ ਮੈਚਿੰਗ ਜਾਂ ਕੁਝ ਵੀ ਦੇਖਣਾ ਉਹਨੂੰ ਅਸੀਂ ਗੂਗਲ ਵਗੈਰਾ 'ਤੇ ਸਰਚ ਮਾਰ ਕੇ ਪਹਿਲਾਂ ਤਾਂ ਉਹਨਾਂ ਦੀ ਤਕਨੀਕ ਦੇਖਣੀ ਜਾਂ ਯੂਟੀਊਬ ਰਾਹੀਂ ਕਿਸੇ ਵੀ ਕਲਾਕਾਰ ਦੀ ਟੈਕਨੀਕ ਨੂੰ ਦੇਖ ਕੇ ਉਸ ਨੂੰ ਅਪਣਾਉਣਾ ਅਪਣਾਉਣਾ ਅਤੇ ਉਹਨੂੰ ਸਹੀ ਕਰਨਾ ਕੀ ਤਕਨੀਕੀ ਹੈ ਜਾਂ ਚਿੱਤਰਕਾਰ ਦੇ ਬਿਹਤਰ ਬਣਾਉਣ ਲਈ ਵੀ ਅਸੀਂ ਉਹ ਯੂਟੀਊਬ ਵਗੈਰਾ ਦੇਖ ਕੇ ਹੀ ਉਹ ਕਰਦੇ ਹਾਂ ਜਾਂ ਫਿਰ ਤਕਨੀਕ ਸਿਖਦੇ ਹਾਂ ਜਾਂ ਹੋਰ ਵੀ ਬਥੇਰੀਆਂ ਨੇ ਕਿਸੇ ਕਲਾਕਾਰ ਨੂੰ ਦੇਖ ਕੇ ਵੀ ਆਪਾਂ ਵਧੀਆ ਚਿੱਤਰਕਾਰੀ ਇੱਕ ਸਾਰਿਆਂ ਦੇ ਸਾਹਮਣੇ ਆਪਾਂ ਪੇਸ਼ ਕਰ ਸਕਦੇ ਹਾਂ ਅਤੇ ਮੈਂ ਕਈ ਉਹਦੇ ਵਿੱਚੋਂ ਨੁਕਤੇ ਸਿੱਖੇ ਹਨ ਕਲਰ ਵਗੈਰਾ ਜਾਂ ਕਲਰ ਦੀ ਲਾ ਲਈਏ ਪੈਂਸਿਲ ਚਲਾਉਣੀ